ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਕਿਵੇਂ ਹੋ ਹਾਂਜੀ ਵਧੀਆ ਹੀ ਹੈ ਜੀ ਹਾਂਜੀ ਠੀਕ ਠਾਕ ਹੈ ਜੀ ਤੁਹਾਡੇ ਬੱਚੇ ਠੀਕ ਆ ਜੀ ਅੱਛਾ ਜੀ ਹੋਰ ਵਧੀਆ ਹੈਗਾ ਜੀ ਹਾਂ ਕਿਵੇਂ ਪਸੰਦ ਕੀਤਾ ਅੱਛਾ ਜੀ ਅੱਛਾ ਜੀ ਸੀਗਾ ਹਾਂਜੀ ਪਿੰਡ 'ਚ ਫਿਰ ਔਖਾ ਹੀ ਹੁੰਦਾ ਸੀ ਨਾ ਉਹ ਕੀ ਨਾਮ ਬਈ ਆਉਣਾ ਜਾਣਾ ਔਖਾ ਹੋ ਜਾਂਦਾ ਹੈਗਾ ਨਾ ਪਿੰਡ 'ਚ ਦੂਰ ਤੇੋਂ ਜਾਂਦਾ ਨਾ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਇੱਥੇ ਤਾਂ ਫਿਰ ਨੇੜੇ ਪੈ ਜਾਂਦਾ ਜਦੋਂ ਮਰਜ਼ੀ ਜਾ ਵੜਦਾ ਬੰਦਾ ਮਰ ਜਾ ਵੜਦਾ ਜਾਂਦਾ ਹੈਗਾ ਅਤੇ ਨਾਲ ਜਵਾਕ ਵੀ ਜਵਾਕ ਵੀ ਜਾ ਵੜਦੇ ਸਕੂਲ ਵੀ ਨੇੜੇ ਪੈ ਜਾਂਦਾ ਨਾ ਇੱਥੇ ਸ਼ਹਿਰ ਦੇ ਵਿੱਚ ਤਾਂ ਹਾਂ

ਹਾਂਜੀ ਹਾਂ ਉੱਥੇ ਫਿਰ ਸਾਧਨ ਹੁੰਦੇ ਨਹੀਂ ਹੈਗੇ ਹਾਂਜੀ ਹਾਂਜੀ ਹਾਂ ਇੱਥੇ ਫਿਰ ਉਹ ਨਾ ਬਈ ਜਾਂਦੇ ਹੈਗੇ ਫਿਰ ਮੁੜ ਕੇ ਆ ਜਾਂਦੇ ਹੈਗੇ ਹਾਂ ਤਾਂ ਕਰਕੇ ਹੋ ਜਾਂਦਾ ਹੈਗਾ ਜੀ ਸ਼ਹਿਰ 'ਚ ਤਾਂ ਬਹੁਤ ਸਹੂਲਤਾਂ ਹੈਗੀਆਂ ਬਈ ਪਿੰਡਾਂ 'ਚ ਐਨੀ ਸਹੂਲਤ ਹੁੰਦੀ ਨਹੀਂ ਹੈਗੀ ਹੈ ਨਾ ਹਾਂ ਓ ਓਕ ਵਧੀਆ ਠੀਕ ਰਹਿਣਾ ਚਾਹੀਦਾ ਠੀਕ ਰਹਿਣਾ ਚਾਹੀਦਾ ਜੀ ਹਾਂ ਹਾਂ ਨੇੜੇ ਪੈ ਜਾਂਦਾ ਇੱਥੇ ਹਾਂ ਨੇੜੇ ਪੈ ਜਾਂਦਾ ਤੁਰ ਕੇ ਵੀ ਜਾ ਸਕਦਾ ਲਿਆ ਸਕਦੇ ਹੈਗੇ ਹਾਂ ਹਾਂ ਉਹ ਤਾਂ ਇਹ ਹੋ ਜਾਂਦਾ ਹੈਗਾ ਨੇੜੇ ਫਿਰ ਵੀ ਇਹਦੇ ਪਿੰਡ ਦੀ ਰੀਸ ਨਹੀਂ ਹੁੰਦੀ ਹੈ ਨਾ ਹਾਂ ਹਾਂ ਪਿੰਡਾਂ 'ਚ ਨਹੀਂ ਹੁੰਦੀ ਨਹੀਂ ਸ਼ਹਿਰ 'ਚ ਹੋ ਜਾਂਦੀ ਵਧੀਆ ਹੁੰਦਾ ਹੈਗਾ ਜੀ

ਹਾਂ ਠੀਕ ਠੀਕ ਠੀਕ ਹੈ ਜੀ ਠੀਕ ਹੈ ਵਧੀਆ ਹਾਂਜੀ ਹਾਂ ਪਰਿਵਾਰ ਸਭ ਵਧੀਆ ਹੈਗਾ ਜੀ ਤੁਸੀਂ ਸੁਣਾਓ ਜੀ ਮਾਰਾਂਗੇ ਜੀ ਗੇੜਾ ਮਾਰਾਂਗੇ ਜੀ ਆਵਾਂਗੇ ਜੀ ਠੀਕ ਹੈ ਜੀ ਠੀਕ